ਛੇ ਨਵੰਬਰ ਅਠਾਰ੍ਹਾਂ ਚੁਹੱਤਰ ਦਸ ਮਾਰਚ ਵੀਹ ਵੀਹ ਚੌਦਾਂ ਮਈ ਉੱਨੀ ਸੱਤਰ ਅਠਾਰ੍ਹਾਂ ਅਕਤੂਬਰ ਅਠਾਰ੍ਹਾਂ ਵੀਹ ਵੀਹ ਜਨਵਰੀ ਵੀਹ ਬਾਈ